ਦੇਖੋ ਜੀ ਕੰਮ ਵਾਲ਼ੀ ਥਾਂ 'ਤੇ ਵਿਵਾਦ ਅਤੇ ਮੁਸ਼ਕਿਲਾਂ ਤਾਂ ਬਹੁਤ ਆਉਂਦੀਆਂ ਏ ਜੀ ਜਿਵੇਂ ਕਿ ਜਦੋਂ ਕਿਤੇ ਵੀ ਜੌਬ ਲੱਗਦੇ ਐਂ ਜੀ ਜਾਂ ਕੁਝ ਵੀ ਕਰਦੇ ਐਂ ਜੋ ਕਿ ਪੁਰਾਣੇ ਬੰਦੇ ਨੇ ਉੱਥੇ ਬਹੁਤ ਹੀ ਇੱਕ ਦੂਜੇ ਦੀਆਂ ਚੁਗਲੀਆਂ ਕਰਦੇ ਨੇ ਜਿਸ ਨਾਲ਼ ਕਿ ਸਾਨੂੰ ਬਹੁਤ ਹੀ ਮੁਸ਼ਕਿਲਾਂ ਦਾ ਅਤੇ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੋ ਬੰਦੇ ਕੋਲ਼ ਐਕਸਪੀਰੀਅਂਸ ਹੁੰਦਾ ਏ ਜੀ ਉਹ ਦੂਜੇ ਬੰਦੇ ਨੂੰ ਥੋੜ੍ਹਾ ਜਾ ਕ ਫੁੱਦੂ ਸਮਜਦਾ ਏ ਜੀ ਜਿਵੇਂ ਕਿ ਵੀ ਇਹ ਅਨਐਜੂਕੇਟਿੱਡ ਹੈ ਵੀ ਜਾਂ ਇਹਦੇ ਕੋਲ਼ ਇੰਨੀ ਨੌਲੇਜ਼ ਨਹੀਂ ਵੀ ਜਿੰਨੀ ਮੇਰੇ ਕੋਲ਼ ਹੈ ਮਤਲਬ ਉਹ ਆਪਣੇ ਆਪ ਨੂੰ ਜੀ ਬਹੁਤ ਹੀ ਹਾਈ ਫ਼ਾਈ ਸਮਜਦਾ ਏ ਜਿਸ ਨਾਲ਼ ਕਿ ਇਹ ਇੱਕ ਵਿਵਾਦ ਵੀ ਬਣ ਜਾਂਦਾ ਏ ਅਤੇ ਜੋ ਫਰੈਸ਼ਰ ਹੁੰਦਾ ਹੈ ਉਹਦੇ ਲਈ ਇਹ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਕਿ ਸੀਨੀਅਰ ਨੂੰ ਜਵਾਬ ਦੇਣਾ ਅਤੇ ਜਿਸ ਨਾਲ਼ ਕਿ ਉਹ ਮਜ਼ਾਕ ਦਾ ਪਾਤਰ ਵੀ ਬਣ ਜਾਂਦਾ ਹੈ ਦੂਜੇ ਲੋਕਾਂ 'ਚ ਦੂਜੇ ਲੋਕਾਂ 'ਚ ਮਜ਼ਾਕ ਦਾ ਪਾਤਰ ਬਣਨ ਕਰਕੇ ਉਹ ਬੰਦਾ ਆਪਣੇ ਆਪ ਨੂੰ ਖੁੱਲ੍ਹ ਕੇ ਅਗਲੇ ਬੰਦੇ ਸਾਹਮਣੇ ਪ੍ਰੈਜੈਂਟ ਨਹੀਂ ਕਰ ਪਾਉਂਦਾ ਜਿਹਦੇ ਨਾਲ਼ ਕਿ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਏ ਬੰਦੇ ਨੂੰ ਉਹ ਟਾਈਮ 'ਤੇ ਸਰਵਾਈਵ ਕਰਨਾ ਜਿਸ ਨਾਲ਼ ਕਿ ਬਹੁਤ ਹੀ ਨੁਕਸਾਨ ਹੋ ਜਾਂਦਾ ਏ ਉਹ ਬੰਦੇ ਦਾ ਵੀ ਅਤੇ ਨਾ ਹੀ ਉਹ ਖੁੱਲ੍ਹ ਕੇ ਕੋਈ ਗੱਲ ਬਾਤ ਕਰ ਪਾਉਂਦਾ ਏ ਅਤੇ ਨਾ ਹੀ ਉਹ ਕੋਈ ਵਿਵਾਦ ਨੂੰ ਸੁਲਝਾ ਪਾਉਂਦਾ ਹੈ ਜਿਸ ਨਾਲ਼ ਕਿ ਬਹੁਤ ਹੀ ਈਫ਼ੈਕਟ ਪੈਂਦਾ ਹੈ ਧੰਨਵਾਦ ਜੀ